ਪੰਜਾਬ ਦੀ ਰਾਜਨੀਤੀ ਪ੍ਰਣਾਲੀ ਵਾਤਾਵਰਨ ਸੁਰੱਖਿਆ ਅਤੇ ਜਿਹੜੇ ਆਪਣੇ ਉਹਦੇ ਟਿਕਾਊ ਵਿਕਾਸ ਦੇ ਮੁੱਦੇ ਹੈ ਉਨ੍ਹਾਂ ਨੂੰ ਹੱਲ ਕਰਨ ਵਿੱਚ ਸਮੇਂ ਸਮੇਂ 'ਤੇ ਯਤਨ ਕਰਦੀ ਹੈ ਇਨ੍ਹਾਂ ਨੇ ਵਾਤਾਵਰਨ ਸੰਭਾਲ ਲਈ ਇੱਕ ਸਮੇਂ ਸਮੇਂ 'ਤੇ ਕਾਨੂੰਨ ਬਣਾਇਆ ਸਮੇਂ ਸਮੇਂ 'ਤੇ ਸੰਭਾਲ ਨੀਤੀਆਂ ਬਣਾਈਆਂ ਹਰੀ ਕ੍ਰਾਂਤੀ ਲੈ ਕੇ ਆਏ ਨਾਲ ਦੀ ਨਾਲ ਜਿਹੜਾ ਆਪਣਾ ਆਰਟੀਕਲ ਅਠਤਾਲੀ ਏ ਹੈ ਉਹ ਕਹਿੰਦਾ ਹੈ ਕਿ ਵਾਤਾਵਰਨ ਰਾਜ ਵਿੱਚ ਜਿਹੜੀ ਵਾਤਾਵਰਨ ਸੁਰੱਖਿਆ ਸੁਧਾਰ ਕਰਨ ਲਈ ਦੇਸ਼ ਦੇ ਜੰਗਲਾਂ ਅਤੇ ਜੀਵਾਂ ਦੀ ਸੁਰੱਖਿਆ ਕਰਨ ਲਈ ਯਤਨ ਕਰ ਰਹੀਆਂ ਮਤਲਬ ਕਿ ਜਿਹੜਾ ਆਪਣਾ ਰਾਜ ਹੈ ਰਾਜ ਸਰਕਾਰ ਹੈ ਜਾਂ ਰਾਜਨੀਤਿਕ ਪਾਰਟੀਆਂ ਨੇ ਇਹ ਆਪਣੇ ਜਿਹੜਾ ਵਾਤਾਵਰਨ ਹੈ ਉਨ੍ਹਾਂ ਦੀ ਰੱਖਿਆ ਕਰਨ ਵਿੱਚ ਹਰ ਸੰਭਵ ਯਤਨ ਕਰੇਗੀ ਇਸ ਤਰ੍ਹਾਂ ਆਪਣੇ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਇਸ ਦੇ ਨਾਲ ਨਾਲ ਆਪਣੇ ਜਿਹੜੇ ਆਪਣੇ ਨਾਗਰਿਕ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਜਿਹੜੇ ਜੰਗਲੀ ਜੰਗਲ ਨੇ ਝੀਲਾਂ ਨੇ ਨਦੀਆਂ ਨੇ ਜੰਗਲੀ ਜੀਵ ਹੈ ਕੁਦਰਤੀ ਸਰੋਤ ਨੇ ਉਨ੍ਹਾਂ ਦੇ ਵੀ ਸਮੇਂ ਸਮੇਂ 'ਤੇ ਉਨ੍ਹਾਂ ਦਾ ਵੀ ਸੁਧਾਰ ਉਨ੍ਹਾਂ ਦੀ ਰੱਖਿਆ ਕਰਨਗੇ ਸੁਧਾਰ ਦੇ ਜੀਵ ਪ੍ਰਣਾਲੀਆਂ ਪ੍ਰਤੀ ਆਪਣੀ ਹਮਦਰਦੀ ਰੱਖਣਗੇ ਵਾਤਾਵਰਨ ਕਾਨੂੰਨ ਆਏ ਪੰਜ ਸਾਲਾਂ ਦੌਰਾਨ ਇੱਕ ਨਵੀਂ ਪੋਲਸੀ ਲਿਆਉਂਦਾ ਜਿਸ ਵਿੱਚ ਵਾਤਾਵਰਨ ਦੇ ਵਾਤਾਵਰਨ ਦੀ ਸੰਭਾਲ ਲਈ ਨਵੇਂ ਨਵੇਂ ਕਾਨੂੰਨ ਬਣਾਏ ਜਾਂਦੇ ਨੇ ਨਵੀਆਂ ਨਵੀਆਂ ਨੀਤੀਆਂ ਬਣਾਈਆਂ ਜਾਂਦੀਆਂ ਨੇ ਹਰੀ ਕ੍ਰਾਂਤੀ ਜਦੋਂ ਆਈ ਆਪਣੇ ਹਰੀ ਕ੍ਰਾਂਤੀ ਆਈ ਉਦੋਂ ਨਵੀਆਂ ਨਵੀਆਂ ਤਕਨੀਕਾਂ ਲੈ ਕੇ ਆਈ ਹਰੀ ਕ੍ਰਾਂਤੀ ਨਾਲ ਸੰਬੰਧਿਤ ਨਵੀਆਂ ਨਵੀਆਂ ਫ਼ਸਲਾਂ ਬੀਜੀਆਂ ਗਈਆਂ ਇਸਦੇ ਨਾਲ ਨਾਲ ਹੀ ਜਦੋਂ ਪੰਜਾਬ ਵਿੱਚ ਉੱਨੀ ਸੌ ਇਕਾਨਵੇਂ ਬਾਨਵੇਂ ਦੇ ਦੌਰਾਨ ਜਾਂ ਜਦੋਂ ਹੜ੍ਹ ਆਏ ਸੀ ਉਸ ਸਮੇਂ ਪੰਜਾਬ ਵਿੱਚ ਜਦੋਂ ਨਰਮਾ ਪੰਜਾਬ ਦੀ ਜਿਹੜੀ ਮਾਲਵਾ ਬੈਲਟ ਸੀ ਉਸ ਵਿੱਚ ਜ਼ਿਆਦਾਤਰ ਨਰਮਾ ਹੀ ਬੀਜਿਆ ਜਾਂਦਾ ਸੀ ਨਰਮੇ ਦੇ ਨਾਲ ਨਾਲ ਉਸ ਟੈਮ ਜਦੋਂ ਹੜ੍ਹ ਆਏ ਜਾਂ ਹੜ੍ਹਾਂ ਦੀ ਵਿੱਚ ਪਾਣੀ ਦੀ ਰੋਕ ਨੂੰ ਕਰਨ ਕੋ ਕੰਟਰੋਲ ਕਰਨ ਲਈ ਉਸ ਸਮੇਂ ਜੀਰੀ ਦੀ ਜੀਰੀ ਬੀਜਣੀ ਸ਼ੁਰੂ ਕੀਤੀ ਗਈ ਜੀਰੀ ਮਤਲਬ ਝੋਨਾ ਝੋਨੇ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਗਈ ਇਸ ਦੇ ਨਾਲ ਨਾਲ ਹੀ ਨਵੇਂ ਨਵੇਂ ਜੋ ਮੁੱਦੇ ਆਉਂਦੇ ਜਿਵੇਂ ਸੁੰਢੀ ਪੈਂਦੀ ਹੈਂ ਹੋਰ ਵੀ ਉਹਦੇ ਵਿੱਚ ਸਮੇਂ ਸਮੇਂ 'ਤੇ ਰੇਆਂ ਸਪਰੇਆਂ ਦੀ ਵਰਤੋਂ ਕਰਕੇ ਸਰਕਾਰ ਨਵੀਆਂ ਨਵੀਆਂ ਨੀਤੀਆਂ ਲਿਆਉਂਦੀ ਹੈ ਨਵੀਆਂ ਨਵੀਆਂ ਕਰ ਆਪਣੀਆਂ ਤਕਨੀਕਾਂ ਦੇ ਅਨੁਸਾਰ ਇਨ੍ਹਾਂ ਦੀ ਸਾਂਭ ਸਾਂਭ ਸੰਭਾਲ ਕਰਦੇ ਅਤੇ ਵਿਕਾਸ ਦੇ ਇਨ੍ਹਾਂ ਟਿਕਾਊ ਵਿਕਾਸ ਦੇ ਮੁੱਦਿਆਂ ਨੂੰ ਹੱਲ ਕਰਦੀ ਹੈ ਧੰਨਵਾਦ